ਤੁਸੀਂ ਨਿਊਡਲ ਟੀ ਵੀ ਸੈਂਟਰ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਤੋਂ ਪਿਛਲੇ ਹਫ਼ਤੇ ਐਲ ਜੀ ਦੀ ਸੈਫਰਨ ਰੈਡ ਇਕ ਸੌ ਪਚਾਸੀ ਲੀਟਰ ਦੀ ਫਰਿਜ ਖਰੀਦੀ ਸੀ ਜੋ ਕਿ ਮੈਨੂੰ ਬਹੁਤ ਵਧੀਆ ਲੱਗੀ ਇਸ ਦੇ ਕਾਫ਼ੀ ਨਵੇਂ ਫੀਚਰ ਹਨ ਇਸ ਦਾ ਫਰੀਜਰ ਮੇਰੀ ਜ਼ਰੂਰਤ ਮੁਤਾਬਿਕ ਹੈ ਇਹ ਕਾਫ਼ੀ ਵਧੀਆ ਕੂਲਿੰਗ ਬਣਾਈ ਰੱਖਦੀ ਹੈ ਇਸਦੇ ਸਾਈਡ ਬੋਤਲਾਂ ਵਾਲੇ ਹੈਂਡਲ ਵਿੱਚ ਵੱਡਾ ਸ਼ੀਲਡ ਕਵਰ ਲੱਗਿਆ ਹੈ ਜੋ ਬੋਤਲਾਂ ਨੂੰ ਡਿੱਗਣ ਤੋਂ ਬਚਾ ਕੇ ਰੱਖਦਾ ਹੈ ਮੈਂ ਆਪਣਾ ਰਿਵਿਊ ਦੇਣ ਲਈ ਤੁਹਾਨੂੰ ਫੋਨ ਕੀਤਾ ਸੀ ਮੈਂ ਇਹ ਕੋਸ਼ਿਸ਼ ਕਰਾਂ ਕਿ ਮੈਂ ਤੁਹਾਡੀ ਦੁਕਾਨ ਬਾਰੇ ਆਪਣੇ ਦੋਸਤਾਂ ਅਤੇ ਜਾਣਕਾਰਾਂ ਨੂੰ ਜ਼ਰੂਰ ਦੱਸਾਂ